ਹਾਂਜੀ ਕੌਣ ਜੀ ਹਾਂਜੀ ਤੁਸੀਂ ਕੌਣ ਜੀ ਹਾਂਜੀ ਕਿਸ ਜਗ੍ਹਾ ਤੋਂ

ਜ਼ਰੂਰ ਜੀ ਕਿਸ ਜਗ੍ਹਾ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਮਾਨਵਵਾਲ ਦੇ ਵਿੱਚ ਜਾਂ ਅੰਮ੍ਰਿਤਸਰ ਦੇ ਬਾਰੇ

ਮਾਨਵਵਾਲ ਦੇ ਵਿੱਚ ਫਸਟ ਏਡ ਵਾਸਤੇ ਤੁਹਾਨੂੰ ਏਕਮਦੀਪ ਕਲੀਨਿਕ ਮਿਲ ਜਾਏਗੀ ਔਰ ਅੰਮ੍ਰਿਤਸਰ ਦੇ ਵਿੱਚ ਸਰਕਾਰੀ ਹੋਸਪਿਟਲ ਜਾਣਾ ਚਾਹੁੰਦੇ ਤਾਂ ਗੁਰੂ ਰਾਮਦਾਸ ਹੋਸਪਿਟਲ ਗੁਰੂ ਨਾਨਕ ਦੇਵ ਹੋਸਪਿਟਲ ਹੈ ਔਰ ਪ੍ਰਾਈਵੇਟ ਜਾਣਾ ਚਾਹੁੰਦੇ ਆ ਸੀ ਐੱਮ ਸੀ ਅਮਨਦੀਪ ਹੋਸਪਿਟਲ ਹੈ ਜਿਹਨਾਂ ਦੇ ਵਿੱਚ ਪੂਰੀਆਂ ਸੁਵਿਧਾਵਾਂ ਤੁਹਾਨੂੰ ਮਿਲ ਜਾਣਗੀਆਂ ਬਿਲਕੁਲ ਜੀ ਬਹੁਤ ਵਧੀਆ ਜੀ ਮਲਟੀ ਸਪੈਸਲਿਸਟ ਹੈ